ਮੇਰੇ ਜ਼ਿਲ੍ਹੇ ਦੇ ਵਿੱਚ ਆਵਾਜਾਈ ਦੇ ਬਹੁਤ ਸਾਰੇ ਸਾਧਨ ਹਨ ਅੱਜ ਦੇ ਟਾਈਮ ਵਿੱਚ

ਰਫਤਾਰ ਜਿਹੜੀ ਹੈ ਇਨਸਾਨ ਦੀ ਉਹ ਬਹੁਤ ਜ਼ਿਆਦਾ ਬਦਲ ਗਈ ਹੈ ਹੁਣ ਲੋਕ ਸਾਈਕਲ ਯਾ ਪੈਦਲ ਚੱਲਣਾ ਅੱਛਾ ਨਹੀਂ ਸਮਝਦੇ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ ਅੱਜਕੱਲ ਹਰੇਕ ਘਰ ਦੇ ਵਿੱਚ ਗੱਡੀ ਹੈਗੀ ਹੈ ਹਰੇਕ ਕੋਈ ਆਪਣੀ ਗੱਡੀ ਵਿੱਚ ਹੀ ਜਾਣਾ ਜ਼ਿਆਦਾਤਰ ਪਸੰਦ ਕਰਦਾ ਹੈ ਜਿਹੜੇ ਲੋਕ ਗੱਡੀ ਨਹੀਂ ਖਰੀਦ ਸਕਦੇ ਉਹ ਬੱਸਾਂ ਦੇ ਦੁਆਰਾ ਜਾਂ ਔਟੋ ਵਗੈਰਾ ਯਾ ਫਿਰ ਮੋਟਰਸਾਈਕਲ ਸਕੂਟਰ ਉਹਦੇ ਜ਼ਰੀਏ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਰਹਿੰਦੇ ਨੇ ਅਤੇ ਜੇ ਕਿਸੀ ਨੇ ਬਾਹਰ ਕਿਤੇ ਦੂਸਰੇ ਦੇਸ਼ ਵਿੱਚ ਜਾਣਾ ਹੋਵੇ ਉਹ ਫਿਰ ਜਿਹੜੇ ਏਅਰਪੋਰਟ ਬਣੇ ਹੋਏ ਨੇ ਉਹਦੇ ਮਦਦ ਨਾਲ ਉੱਥੇ ਤੋਂ ਹੋ ਕੇ ਜਾ ਸਕਦੇ ਨੇ